ਹੈਲੋ ਹੋਰ ਕੀ ਕਰਦੇ ਹੋ ਠੀਕ ਠੀਕ ਹਾਂ ਨਹੀਂ ਬਸ ਡਿਊਟੀ 'ਤੇ ਹੀ ਹਾਂ ਮੈਂ ਬਸ ਅਤੇ ਲੱਗੇ ਪਏ ਸੀ ਥੋੜ੍ਹਾ ਜਿਹਾ ਫਰੀ ਸੀਗਾ ਤਾਂ ਮੈਂ ਕਿਹਾ ਚੱਲ ਫੋਨ ਹੀ ਕਰ ਲਵਾਂ ਤੁਹਾਨੂੰ ਹਾਂ ਸੈਲਰੀ ਪੈ ਗਈ ਹੈ ਵੈਸੇ ਅੱਜ ਦੱਸੋ ਕੀ ਕੁਛ ਚਾਹੀਦਾ ਆਪਾਂ ਨੂੰ ਠੀਕ ਠੀਕ ਹੈ ਠੀਕ ਹੈ ਠੀਕ ਹੈ ਅਤੇ ਠੀਕ ਹੈ ਠੀਕ ਹੈ ਚਲੋ ਠੀਕ ਹੈ ਠੀਕ ਠੀਕ ਠੀਕ ਹੈ ਫਿਰ ਹੈ ਕਰਿਓ ਨਾ ਤੁਸੀਂ ਵੀ ਮੈਂ ਚਲੋ ਜਦੋਂ ਫਰੀ ਹੋ ਗਿਆ ਉਦੋਂ ਮੈਂ ਤੁਹਾਨੂੰ ਮੈਸੇਜ ਲਾ ਦੂ ਤੁਸੀਂ ਆਪਣੀ ਲਿਸਟ ਲੁਸਟ ਬਣਾ ਕੇ ਰੱਖਿਓ ਅਤੇ ਜੋ ਵੀ ਆਪਣਾ ਸਾਰਾ ਸਮਾਨ ਤੁਹਾਨੂੰ ਜ਼ਰੂਰਤ ਹੈ ਅਤੇ ਫਿਰ ਮੈਂ ਜਦੋਂ ਆਵਾ ਓਦੋਂ ਖਾਣਾ ਵਗੈਰਾ ਖਾ ਕੇ ਫਿਰ ਆਪਾਂ ਜਾ ਆਵਾਂਗੇ ਬਾਜ਼ਾਰ ਅਤੇ ਆਪਾਂ ਖਰੀਦ ਲਿਆਵਾਂਗੇ ਫਿਰ ਜਿਹੜਾ ਜ਼ਰੂਰਤ ਹੋਵੇ ਤੁਹਾਨੂੰ ਹੋਰ ਕੀ ਬਣਾਇਆ ਸਬਜ਼ੀ ਕੀ ਬਣਾਈ ਅੱਜ ਠੀਕ ਹੈ ਠੀਕ ਹੈ ਠੀਕ ਠੀਕ ਹੈ ਬਾਕੀ ਹੋਰ ਕੁਛ ਸਮਾਨ ਸ਼ੌਪ ਦਾ ਵੀ ਲੈਣਾ ਆਪ ਦੀ ਦਾ ਠੀਕ ਠੀਕ ਹੈ ਨਹੀਂ ਨਹੀਂ ਆਪਣੀ ਸ਼ੌਪ ਦਾ ਜਿਹੜਾ ਪਾਰਲਰ ਦਾ ਕੁਛ ਲੈਣਾ ਤਾਂ ਠੀਕ ਹੈ ਠੀਕ ਠੀਕ ਹੈ ਠੀਕ ਠੀਕ ਹੈ ਠੀਕ ਚਲੋ ਕੋਈ ਨਹੀਂ ਚਲੋ ਉਹ ਤਾਂ ਤੁਸੀਂ ਦੇਖਣਾ ਜੋ ਤੁਹਾਨੂੰ ਜ਼ਰੂਰਤ ਹੈ ਅਤੇ ਮੈਂ ਤਾਂ ਜਦੋਂ ਆਪਣਾ ਫਰੀ ਹੋ ਗਿਆ ਫਿਰ ਮੈਂ ਉਦੋਂ ਆਜੂਗਾ ਨਾਲੇ ਲੰਚ ਵਗੈਰਾ ਕਰਕੇ ਚਲ ਜਾ ਅਤੇ ਨਾਲੇ ਆਪਣਾ ਅਤੇ ਮੈਂ ਉਹ ਦੇਖ ਲਿਓ ਤੁਸੀਂ ਜੇ ਤੁਹਾਨੂੰ ਜ਼ਰੂਰਤ ਹੈ ਮੇਰਾ ਤਾਂ ਚਲੋ ਪਏ ਪੈ ਪੇ ਪੈ ਹੀ ਗਏ ਅੱਛਾ ਅੱਛਾ ਠੀਕ ਠੀਕ ਠੀਕ ਹੈ ਠੀਕ ਠੀਕ ਹੈ ਠੀਕ ਠੀਕ ਹੈ ਚਲੋ ਕੋਈ ਨਹੀਂ ਉਹ ਤਾਂ ਤੁਸੀਂ ਜਿਹੜਾ ਕੁਛ ਕਹੁੰਗੇ ਅਤੇ ਉਹ ਤਾਂ ਆਪਾਂ ਲੈ ਆਵਾਂਗੇ ਹਾਂ ਜਿਹੜਾ ਜ਼ਰੂਰਤ ਦਾ ਉਹ ਤਾਂ ਲਿਆਉਣਾ ਹੀ ਲਿਆਉਣਾ ਫਿਰ ਆਪਾਂ ਹਾਂ ਉਹ ਤੁਸੀਂ ਉਹ ਦੇਖ ਲਓ ਜੇ ਤੁਸੀਂ ਉਹ ਵਧੀਆ ਸੈਟਿੰਗ ਕਰ ਸਕਦੇ ਹੋ ਸੋ ਘਰ ਦਾ ਦੁੱਧ ਚੰਗਾ ਹੁੰਦਾ ਘਰ ਦਾ ਘਿਓ ਵਗੈਰਾ ਅਤੇ ਨਾਲੇ ਚਲੋ ਆਪਣਾ ਬਜਟ ਬਜਟ ਦੀ ਸੈਟਿੰਗ ਆ ਜਾਂਦੀ ਹੈ ਨਾਲੇ ਉਹ ਤੁਸੀਂ ਦੇਖ ਲਿਓ ਉਹ ਵੀ ਪਰ ਤੁਸੀਂ ਆਪਣਾ ਸਾਰਾ ਲਿਸਟ ਲੁਸਟ ਜਿਹੀ ਤਿਆਰ ਹੀ ਰੱਖਿਓ ਜਿਹੜਾ ਵੀ ਜੋ ਜ਼ਰੂਰ ਹੋਵੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਗੀ ਆਪਾਂ ਨੂੰ ਤਾਂ ਪੇ ਪਈ ਗਈ ਫਿਰ ਨਾਲੇ ਮੰਥ ਦਾ ਪੂਰਾ ਮਹੀਨਾ ਫਿਰ ਸੌਖੇ ਹੋ ਜਾਂਗੇ ਆਪਾਂ ਅੱਛਾ ਚੱਲ ਰਿਹਾ ਹਾਂ ਹਾਂ ਚਲੋ ਠੀਕ ਆ ਠੀਕ ਆ ਚਲੋ ਕੋਈ ਨਹੀਂ ਬਾਕੀ ਤੁਸੀਂ ਫਿਰ ਵੀ ਆਪਣਾ ਸਾਰਾ ਨੋਟ ਕਰ ਲਿਓ ਕੋਈ ਮਿਸ ਨਾ ਹੋਵੇ ਕਿਉਂਕਿ ਫਿਰ ਮੈਨੂੰ ਡਿਊਟੀ ਕਰਕੇ ਵਾਪਸ ਟਾਈਮ ਨਹੀਂ ਨਾ ਲੱਗਦਾ ਹਾਂ ਫਿਰ ਐਂ ਨਾ ਡਿਊਟੀ ਕਰਕੇ ਮੇਰੀ ਵੀ ਸੈਟਿੰਗ ਨਹੀਂ ਹੁੰਦੀ ਹਾਂਜੀ ਹਾਂਜੀ ਅਤੇ ਉਹ ਫਿਰ ਐਂ ਨਾ ਡਿਊਟੀ ਕਰਕੇ ਫਿਰ ਹਾਂ ਫਿਰ ਐਂ ਡਿਊਟੀ 'ਚ ਮੈਨੂੰ ਵੀ ਫਿਰ ਕੰਮ 'ਤੇ ਫਿਰ ਟਾਈਮ ਨਹੀਂ ਮਿਲਦਾ ਅਤੇ ਤੁਸੀਂ ਵੀ ਟੈਨਸ਼ਨ ਫਰੀ ਹੋ ਜੋਂਗੇ ਅਤੇ ਚਲੋ ਮੈਨੂੰ ਵੀ ਐਂ ਹੋ ਜਾਂਦਾ ਵੀ ਟੈਂਸ਼ਨ ਸਾਰਾ ਆਪਣਾ ਹੈਗਾ ਹੀ ਆ ਘਰ ਦਾ ਸਮਾਨ ਹਾਂਜੀ ਹਾਂਜੀ ਹਾਂ ਹਾਂ ਚਲੋ ਬਾਕੀ ਮੈਂ ਤੁਹਾਨੂੰ ਦੱਸ ਦੂੰਗੀ ਸਾਰਾ ਉਹ ਜਦੋਂ ਵੀ ਆਉਣਾ ਹੋਇਆ ਦੱਸ ਦੂੰਗਾ ਮੈਂ ਅਤੇ ਤੁਸੀਂ ਬਸ ਆਪਣਾ ਰੈਡੀ ਨਹਾ ਧੋ ਕੇ ਰੈਡੀ ਹੋ ਕੇ ਪੂਰਾ ਆਪਣਾ ਸਾਰਾ ਖਾਣਾ ਵਗੈਰਾ ਤਿਆਰ ਕਰਕੇ ਫਰੀ ਹੋ ਜਿਓ ਬਿਲਕੁਲ ਵੀ ਮੈਨੂੰ ਟਾਈਮ ਓਨਾ ਕੁ ਹੀ ਹੈ ਫਿਰ ਮੈਂ ਛੇਤੀ ਆਪਣਾ ਵਾਪਸ ਜਾਣਾ ਹੋਵੇਗਾ ਠੀਕ ਆ ਹਾਂ ਹਾਂ ਹਾਂ ਹਾਂ ਠੀਕ ਆ ਓਕੇ ਚਲੋ ਠੀਕ ਹੈ ਜੀ